ਘੁੰਮਣਾ ਮੇਰਾ ਪੈਸ਼ਨ ਹੈ ਅਤੇ ਮੈਂ ਹਮੇਸ਼ਾ ਹਰ ਸਾਲ ਇੱਕ ਸਾਲ ਕੀ ਹਰ ਸਾਲ ਕੀ ਸਾਲ 'ਚ ਦੋ ਜਾਂ ਤਿੰਨ ਵਾਰ ਘੁੰਮਣ ਚਲਾ ਜਾਂਦਾ ਆਪਣੇ ਕਦੀ ਮੋਟਰਸਾਈਕਲ 'ਤੇ ਕਦੀ ਆਪਣੀ ਕਾਰ 'ਤੇ ਅਤੇ ਮੈਂ ਹਰ ਵਾਰ ਇਕੱਲਾ ਨਹੀਂ ਘੁੰਮਣ ਜਾਂਦਾ ਕਈ ਵਾਰ ਮੇਰੇ ਦੋਸਤ ਨਾਲ ਹੁੰਦੇ ਨੇ ਅਤੇ ਦੋਸਤਾਂ ਨਾਲ ਘੁੰਮਣਾ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਪਿਛਲੇ ਤੋਂ ਪਿਛਲੇ ਸਾਲ ਮਕਲੋਡਗੰਜ ਗਿਆ ਸੀ ਆਪਣੇ ਦੋਸਤਾਂ ਨਾਲ ਉਸ ਤੋਂ ਉਸੇ ਸਾਲ ਛੇ ਮਹੀਨੇ ਬਾਅਦ ਮੈਂ ਪਤਲੀ ਡੁੱਬ ਗਿਆ ਸੀ ਉਹਨਾਂ ਦੋਸਤਾਂ ਨਾਲ ਅਸੀਂ ਬੜਾ ਹੀ ਉੱਥੇ ਆਨੰਦ ਮਾਣਿਆ ਖੂਬ ਚੰਗੀ ਦਾਰੂ ਪੀਤੀ ਚੰਗਾ ਚਿਕਨ ਪਾੜਿਆ ਅਤੇ ਫਿਰ ਅਸੀਂ ਉਸ ਤੋਂ ਬਾਅਦ ਵਾਪਸ ਆ ਗਏ ਜੰਮੂ ਜੰਮੂ ਆ ਗਏ ਅਸੀਂ ਰ ਹੋਟਲ ਵਿੱਚ ਰਹੇ ਉਦ ਉਹਦੇ ਨਾਲ ਅਸੀਂ ਪਹਿਲਾਂ ਹੀ ਕਰ ਲਿਆ ਸੀ ਕਿ ਅਸੀਂ ਦਾਰੂ ਚਿਕਨ ਸਭ ਆਪਣਾ ਬਣਾਉਣਾ ਆ ਅਤੇ ਉਹ ਨੂੰ ਅਸੀਂ ਮੀਲਸ ਦਾ ਪੇ ਕਰਤਾ ਸੀਗਾ ਅਤੇ ਅਸੀਂ ਉੱਥੇ ਆਪਣਾ ਖਾ ਪਿਗਾ ਬਣਾਇਆ ਅਤੇ ਖੂਬ ਦਾਰੂ ਪੀਤੀ ਨਾਲ ਹੋਟਲ ਦੇ ਮੈਨੇਜਰ ਨੂੰ ਵੀ ਪਿਲਾਈ ਅਤੇ ਸਾਨੂੰ ਪਤਾ ਲੱਗਾ ਕਿ ਬਾਅਦ 'ਚ ਹੋ ਹੋਟਲ ਦੇ ਮੈਨੇਜਰ ਨੂੰ ਉਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ